ਮੈਂ ਸੋਨੀ ਕੰਪਨੀ ਤੋਂ ਓਵਰ ਈਅਰ ਵਾਲੇ ਹੈਡਫੋਨ ਔਨਲਾਈਨ ਔਡਰ ਕੀਤੇ ਸੀ ਇਹ ਹੈਡਫੋਨ ਮੈਂ ਫੋਨ ਵਿੱਚੋਂ ਸਰਚ ਕਰਕੇ ਐਮਾਜੋਨ ਤੋਂ ਔਨਲਾਈਨ ਔਡਰ ਕੀਤੇ ਸੀ ਅਤੇ ਇਹ ਮੈਂ ਪੰਦਰਾਂ ਬਾਰਾਂ ਦੋ ਹਜ਼ਾਰ ਤੇਈ ਨੂੰ ਡਿਲੀਵਰੀ ਲਿਖਿਆ ਸੀ ਪਰ ਹੈ ਨਾ ਇਹ ਮੇਰੇ ਕੋਲ ਅਠਾਰ੍ਹਾਂ ਤਰੀਕ ਨੂੰ ਪਹੁੰਚੇ ਸੀਗੇ ਜਦੋਂ ਜਦੋਂ ਇਹ ਮੇਰੇ ਕੋਲ ਪਹੁੰਚੇ ਤਾਂ ਇਹਨਾਂ ਦੀ ਪੈਕਿੰਗ ਬਹੁਤ ਘਟੀਆ ਬਿਲਕੁਲ ਖਰਾਬ ਕੀਤੀ ਹੋਈ ਸੀ ਅਤੇ ਜਦੋਂ ਇਹ ਜਦੋਂ ਇਹ ਵਿੱਚੋਂ ਮੈਂ ਕੱਢੇ ਤਾਂ ਇੱਕ ਸਾਈਡ ਤੋਂ ਟੁੱਟੇ ਹੋਏ ਸਨ ਜਦੋਂ ਮੈਂ ਇਹਨਾਂ ਨੂੰ ਕਨੈਕਟ ਕਰਕੇ ਵੇਖਿਆ ਤਾਂ ਇੱਕ ਵਾਲੇ ਇੱਕ ਪਾਸੇ ਵਾਲੇ ਹੈਡਫੋਨ ਵਿੱਚੋਂ ਆਵਾਜ਼ ਆ ਰਹੀ ਸੀ ਅਤੇ ਇੱਕ ਪਾਸੇ ਵਾਲੇ ਵਿੱਚੋਂ ਆਵਾਜ਼ ਬਿਲਕੁਲ ਵੀ ਨਹੀਂ ਆ ਰਹੀ ਸੀ ਅਤੇ ਇਹਨਾਂ ਲਈ ਮੈਂ ਬਹੁਤ ਐਕਸਾਈਟਿਡ ਸੀ ਕਿ ਮੈਂ ਹੈਡਫੋਨ ਲਾ ਕੇ ਕੋਈ ਵੀ ਜੇ ਕੰਮ ਕਰਨਾ ਏ ਮੈਂ ਘੁੰਮ ਘੁੰਮਣਾ ਫਿਰਨਾ ਅਤੇ ਮੈਂ ਹੈਡਫੋਨ ਲਾ ਕੇ ਕਰਾਂਗੀ ਅਤੇ ਹੈ ਨਾ ਇਹ ਮੇਰਾ ਚਾਅ ਅਧੂਰਾ ਹੀ ਰਹਿ ਗਿਆ ਹੈ ਨਾ ਇਸ ਨਾਲ ਮੇਰੇ ਪੈਸੇ ਵੀ ਖਰਾਬ ਹੋ ਗਏ ਅਤੇ ਮੈਨੂੰ ਬਹੁਤ ਬੁਰਾ ਲੱਗਿਆ